ਪੰਜਾਬ ਵਿੱਚ ਸਥਾਨਕ ਕਲਾ ਅਤੇ ਸ਼ਿਲਪਕਾਰੀ ਦੇ ਦ੍ਰਿਸ਼ ਨਾਲ ਜੁੜਨ ਦੇ ਬਹੁਤ ਹੀ ਜ਼ਿਆਦਾ ਮੌਕੇ ਮਿਲਦੇ ਹਨ ਜਿਵੇਂ ਕਿ ਅਸੀਂ ਸੋਚੇ 'ਤੇ ਚਲੀਏ ਪੰਜਾਬ ਵਿੱਚ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਵੁੱਡ ਭਾਂਡਿਆਂ ਦੀ ਕਲਾਕਾਰੀ ਬਹੁਤ ਹੀ ਜ਼ਿਆਦਾ ਦੇਖਣ ਨੂੰ ਮਿਲਦੀ ਹੈ ਤਰ੍ਹਾਂ ਤਰ੍ਹਾਂ ਦੀ ਦੇਖਣ ਨੂੰ ਮਿਲਦੀ ਹੈ ਭਾਂਡਿਆਂ ਨੂੰ ਆਕਾਰ ਦਿੱਤਾ ਜਾਂਦਾ ਹੈ ਅਤੇ ਲੱਕੜ ਦੀ ਤਰ੍ਹਾਂ ਤਰ੍ਹਾਂ ਦੀ ਕਲਾਕਾਰੀ ਵੇਖਣ ਨੂੰ ਮਿਲਦੀ ਹੈ ਲੱਕੜ ਦੀ ਬਹੁਤ ਹੀ ਜ਼ਿਆਦਾ ਤਕਨੀਕ ਵਰਤੀ ਜਾਂਦੀ ਆ ਜਿਹਦੇ ਵਿੱਚ ਭਾਂਡੇ ਵੀ ਬਣਾਏ ਜਾਂਦੇ ਹਨ ਲੱਕੜ ਦੇ ਅਤੇ ਲੱਕੜ ਦੇ ਕੱਪ ਗਲਾਸ ਕੜੇ ਅਤੇ ਅਤੇ ਬਹੁਤ ਹੀ ਜ਼ਿਆਦਾ ਤਰ੍ਹਾਂ ਦੇ ਬੈੱਡ ਸੋਫੇ ਵੀ ਬਣਾਏ ਜਾਂਦੇ ਹਨ ਪੰਜਾਬ ਵਿੱਚ ਹੋਰ ਵੀ ਤਰ੍ਹਾਂ ਬਹੁਤ ਜ਼ਿਆਦਾ ਚੀਜ਼ਾਂ ਬਣਾਈਆਂ ਜਾਂਦੀਆਂ ਹਨ ਜਿਵੇਂ ਕਿ ਪਰਾਂਦੀਆਂ ਕੜੇ ਆਦਿ ਵੀ ਬਣਾਏ ਜਾਂਦੇ ਹਨ ਪੰਜਾਬ ਵਿੱਚ ਅਤੇ ਪੰਜਾਬ ਦੇ ਅੰਮ੍ਰਿਤਸਰ ਅਤੇ ਹੋਰ ਵੀ ਜ਼ਿਲ੍ਹਿਆਂ ਵਿੱਚ ਹਰ ਜਗ੍ਹਾ 'ਤੇ ਚੂੜਾ ਵੀ ਬਣਾਇਆ ਜਾਂਦਾ ਹੈ ਅਤੇ ਮਿੱਟੀ ਦੇ ਭਾਂਡੇ ਤਰ੍ਹਾਂ ਤਰ੍ਹਾਂ ਦੇ ਮਿੱਟੀ ਦੇ ਭਾਂਡੇ ਵੀ ਬਣਾਏ ਜਾਂਦੇ ਹਨ ਅੰਮ੍ਰਿਤਸਰ ਦੇ ਪਿੰਡਾਂ ਵਿੱਚ ਹੋਰ ਵੀ ਤਰ੍ਹਾਂ ਤਰ੍ਹਾਂ ਦੀਆਂ ਕਲਾਕਾਰੀਆਂ ਮਿਲਣ ਵੇਖਣ ਨੂੰ ਮਿਲਦੀਆਂ ਹਨ ਜਿਵੇਂ ਕਿ ਗੱਤਕਾ ਬਾਜੀ ਪਰਾਂਦੀਆਂ ਬਣਾਉਣਾ ਭਾਂਡੇ ਬਣਾਉਣਾ ਅਤੇ ਲੱਕੜ ਦੀਆਂ ਤਰ੍ਹਾਂ ਤਰ੍ਹਾਂ ਦੀਆਂ ਚੀਜ਼ਾਂ ਬਣਾਉਣੀਆਂ